ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਹਾਂਜੀ ਹਾਂ ਜੀ ਸਤਿ ਸ਼੍ਰੀ ਅਕਾਲ ਹਾਂਜੀ ਵਧੀਆ ਤੁਸੀਂ ਦੱਸੋ ਅੱਛਾ ਜੀ ਅੱਛਾ ਕਿ ਇਹ ਤੁਸੀਂ ਕਿਹੜੀ ਲੈਣੀ ਸੀ ਜਮੈਂਟਰੀ ਇੱਕ ਸਸਤੇ ਭਾਅ 'ਚ ਹੈ ਜੀ ਇੱਕ ਮਹਿੰਗੇ 'ਚ ਹੈ ਅੱਛਾ ਜੀ ਹਾਂ ਅੱਛਾ ਹਾਂਜੀ ਉਹ ਬਹੁਤ ਵਧੀਆ ਅਤੇ ਉਹ ਤੁਹਾਡਾ ਬੱਚਾ ਜਦੋਂ ਸਕੂਲ 'ਚ ਲੈ ਕੇ ਜਾਊਗਾ ਵਧੀਆ ਖੁਸ਼ ਹੋਊਗਾ ਅਤੇ ਹੋਰ ਬੱਚਿਆਂ ਨੂੰ ਵੀ ਦੱਸੂਗਾ ਵੀ ਵਧੀਆ ਜਮੈਂਟਰੀ ਵੀ ਸ਼ੋਪ ਤੋਂ ਲੈ ਕੇ ਆਉਂਦੀ ਹੈ ਅਤੇ ਤੁਸੀਂ ਹੋਰ ਪੈਨਸਲਾਂ ਅਤੇ ਰੇਜਰ ਵੀ ਲੈਣੀਆਂ ਅੱਛਾ ਜੀ ਹਾਂਜੀ ਇੱਕ ਤਾਂ ਪੈਂਸਲਾਂ ਦਸ ਰੁਪਏ ਦੀ ਹੈ ਜੀ ਵਧੀਆ ਇੱਕ ਉਦੋਂ ਵਧੀਆ ਜਿਹੜੀ ਹੈਗੀ ਉਹ ਵੀਹ ਰੁਪਏ ਦੀ ਹੈ ਜੀ ਅਤੇ ਰੇਜਰ ਵੀ ਇੱਕ ਪੰਜ ਰੁਪਏ ਵਾਲੀ ਵਧੀਆ ਜੀ ਇੱਕ ਦਸ ਰੁਪਏ ਵਾਲੀ ਵਧੀਆ ਹੈਗੀ ਹੈ ਜੀ ਤੁਸੀਂ ਦੱਸੋ ਅੱਛਾ ਠੀਕ ਹੈ ਜੀ ਅੱ ਅੱਛਾ ਜੀ ਹਾਂ ਹਾਂਜੀ ਇਕ ਹਾਂਜੀ ਕਿੱਟ ਵੀ ਅਲਗ ਅਲਗ ਪ੍ਰਕਾਰ ਦੀਆਂ ਜੀ ਬਹੁਤ ਵਧੀਆ ਵਧੀਆ ਅਤੇ ਤੁਸੀਂ ਦੇਖ ਲਿਓ ਜੀ ਸ਼ੋਪ ਤੋਂ ਜਿਹੜੀ ਤੁਹਾਨੂੰ ਵਧੀਆ ਲੱਗੀ ਅਸੀਂ ਉਹੀ ਦੇ ਦਿਆਂਗੇ ਤੁਹਾਨੂੰ ਹਾਂਜੀ ਹਾਂਜੀ ਜੀ

ਅੱਛਾ ਠੀਕ ਹੈ ਜੀ ਕੋਈ ਗੱਲ ਨਹੀਂ ਓ ਥੈ ਥੈਂਕ ਯੂ